ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਪਿਛਲੇ ਦੋ ਹਫਤੇ ਪਹਿਲਾਂ ਤੁਹਾਡੀ ਦੁਕਾਨ 'ਤੇ ਆਈ ਸੀ ਤੁਸੀਂ ਮੈਂ ਤੁਹਾਡੀ ਦੁਕਾਨ ਤੋਂ ਇੰਡਕਸ਼ਨ ਚੁੱਲ੍ਹਾ ਖਰੀਦਿਆ ਸੀ ਅਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਸ ਇੰਡਕਸ਼ਨ ਚੁੱਲ੍ਹੇ ਦੀ ਆਪਾਂ ਡਿਲੀਵਰੀ ਫਰੀ ਕਰਕੇ ਜਾਵਾਂਗੇ ਘਰ ਤੱਕ ਪਹੁੰਚਾ ਕੇ ਜਾਵਾਂਗੇ ਅਤੇ ਆਉਣ ਵਾਲੇ ਸਮੇ 'ਚ ਅਗਰ ਇਹ ਚੁੱਲ੍ਹੇ 'ਚ ਕੋਈ ਖਰਾਬੀ ਆਉਂਦੀ ਆ ਤਾਂ ਅਸੀਂ ਫਰੀ ਸਰਵਿਸ ਕਰਕੇ ਜਾਵਾਂਗੇ ਪਰ ਮੈਂ ਦੇਖਿਆ ਕਿ ਫਰੀ ਡਿਲੀਵਰੀ ਦੇ ਚੱਕਰ 'ਚ ਤੁਸੀਂ ਇੱਕ ਹਫਤਾ ਲੇਟ ਸਾਨੂੰ ਇਹ ਘਰ ਪਹੁੰਚਾ ਕੇ ਗਏ ਹੋ ਜਦ ਇਹ ਇੰਡਕਸ਼ਨ ਘਰ ਆਇਆ ਤਾਂ ਮੈਂ ਦੇਖਿਆ ਇਹਦੀ ਪੈਕਜਿੰਗ ਬਹੁਤ ਹੀ ਗਲਤ ਤਰੀਕੇ ਨਾਲ ਕੀਤੀ ਗਈ ਸੀ ਬਿਲਕੁਲ ਵੀ ਸੁਰੱਖਿਅਤ ਤਰੀਕੇ ਦੇ ਨਾਲ ਇਸਦੀ ਪੈਕਿੰਗ ਨਹੀਂ ਸੀ ਜਦ ਮੈਂ ਖੋਲ੍ਹ ਕੇ ਦੇਖਿਆ ਤਾਂ ਇਹਦੇ ਪਲੱਗ ਦੇ ਵਿੱਚ ਵੀ ਕਾਫੀ ਪ੍ਰੋਬਲਮ ਸੀ ਜਦੋਂ ਆਪਾਂ ਇਹਨੂੰ ਚਲਾ ਕੇ ਦੇਖਿਆ ਤਾਂ ਇਹ ਪੂਰੀ ਤਰ੍ਹਾਂ ਹੀਟ ਨਹੀਂ ਦੇ ਰਿਹਾ ਹੈ ਕੀ ਤੁਸੀਂ ਮੈਨੂੰ ਇਹ ਚੁੱਲ੍ਹਾ ਚੇਂਜ ਕਰਕੇ ਦੇ ਸਕਦੇ ਹੋ ਜਾਂ ਫਿਰ ਮੈਨੂੰ ਜਿੰਨੇ ਪੈਸੇ ਮੈਂ ਦਿੱਤੇ ਸੀ ਉਹ ਸਾਰੇ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਮੈਨੂੰ ਇਹਦੀ ਜਗ੍ਹਾ ਇੱਕ ਦੂਜਾ ਨਵਾਂ ਇੰਡਕਸ਼ਨ ਦਿੱਤਾ ਜਾਵੇ